ਸਾਡੇ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਹੈ ਤਾਂ ਠੀਕ ਹੈ ਪਰ ਬਹੁਤ ਹੱਦੋਂ ਗ਼ਲਤ ਵੀ ਹੈ ਇੱਕ ਤਾਂ ਇਹ ਵੀ ਚਲੋ ਬੱਚਿਆਂ ਨੂੰ ਸਿੱਖਿਆ ਮਿਲ ਰਹੀ ਹੈ ਬੱਚੇ ਸਿੱਖਿਆ ਲੈ ਵੀ ਰਹੇ ਨੇ ਪਰ ਕਈ ਸਿੱਖਿਆ ਖਾਤਰ ਦੂਰ ਵੀ ਜਾਣਾ ਪੈਂਦਾ ਹੈ ਪਰ ਬੱਚੇ ਫਿਰ ਵੀ ਪ੍ਰੋਪਰ ਆਪਣੀ ਸਿੱਖਿਆ ਪ੍ਰਾਪਤ ਕਰ ਰਹੇ ਅਤੇ ਇਹ ਹੈ ਕਿ ਦੂਜੇ ਦੇਸ਼ਾਂ ਨਾਲੋਂ ਦੀ ਤੁਲਨਾ ਵਿੱਚ ਸਾਡੇ ਦੇਸ਼ ਦੀ ਜਿਹੜੀ ਸਿੱਖਿਆ ਹੈ ਬਹੁਤ ਵਧੀਆ ਹੈ ਬੱਚਿਆਂ ਨੂੰ ਪੂਰੀ ਤਾਲੀਮ ਵੀ ਮਿਲ ਰਹੀ ਹੈ ਗੀ ਸਾਡੇ ਬੱਚੇ ਇਥੋਂ ਦੀ ਹੀ ਗ੍ਰੈਜੁਏਸ਼ਨ ਲੈ ਕੇ ਦੂਜੇ ਦੇਸ਼ਾਂ ਵਿੱਚ ਜਾਂਦੇ ਨੇ ਉੱਥੇ ਆਪਣੀ ਪੂਰੀ ਕਰ ਰਹੇ ਹੈ ਅਤੇ ਨਾਲ ਦੇ ਨਾਲ ਆਪਣਾ ਕੰਮ ਵੀ ਇੱਕ ਇਹਦੇ ਵਿੱਚ ਕਮੀ ਇਹ ਗੱਲ ਦੀ ਹੈ ਕਿ ਸਾਡੇ ਬੱਚਿਆਂ ਨੂੰ ਇੱਥੇ ਕੋਈ ਵੀ ਸਕੋਲਰਸ਼ਿੱਪ ਵਗੈਰਾ ਨਹੀਂ ਮਿਲਦੀ ਜਿਹਦੇ ਕਰਕੇ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਹੈ ਜਿਹੜੇ ਇੰਨੇ ਦਿਨ ਰਾਤ ਮਿਹਨਤ ਕਰਦੇ ਹੈ ਪੜ੍ਹਦੇ ਹੈ ਟਿਊਸ਼ਨਾਂ ਵੀ ਲੈਂਦੇ ਹੈ ਠੀਕ ਹੈ ਨਾ ਉਹਨਾਂ ਦੇ ਘਰ ਦੇ ਖਰਚੇ ਕਿਵੇਂ ਚੱਕਦੇ ਕਿਵੇਂ ਨਹੀਂ ਚੱਕਦੇ ਇਹ ਤਾਂ ਦੇਖੋ ਸਭ ਨੂੰ ਪਤਾ ਹੀ ਵੀ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਸਿੱਖਿਆ ਲਈ ਕਰਵਾਉਣੀ ਕਿੰਨੀ ਜ਼ਰੂਰੀ ਹੈ ਅਤੇ ਉਹਦੇ ਬਾਵਜੂਦ ਵੀ ਬੱਚਿਆਂ ਨੂੰ ਪ੍ਰੋਪਰ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਉਰੇ ਜੋਪ ਨਹੀਂ ਮਿਲਦੀ ਕੋਈ ਬੱਚਿਆਂ ਦੇ ਇਸ ਪੜ੍ਹਾਈ ਦਾ ਮੁੱਲ ਬਿਲਕੁਲ ਨਹੀਂ ਪੈ ਰਿਹਾ ਇਸ ਕਰਕੇ ਬੱਚਿਆਂ ਦੀ ਪੜ੍ਹਾਈ ਵੱਲ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਐਵੇਂ ਦੀ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਹੀਂ ਕਰਨੀ ਚਾਹੀਦੀ ਵੀ ਉਹ ਦੂਜੇ ਦੇਸ਼ਾਂ ਵਿੱਚ ਜਾਣ ਉੱਥੇ ਜਾ ਕੇ ਆਪਣੀ ਪੜ੍ਹਾਈ ਦਾ ਸਿੱਖਿਆ ਦਾ ਉਹ ਕਰਦੇ ਗੇ ਠੀਕ ਹੈ ਉਹ ਤਾਂ ਜੇ ਬੱਚਿਆਂ ਨੂੰ ਇੱਥੇ ਹੀ ਪੂਰੀ ਪੂਰਾ ਪ੍ਰਬੰਧ ਮਿਲੇ ਪੂਰੀ ਗ੍ਰੈਜੂਏਸ਼ਨ ਦੇਣ ਇਹ ਬੱਚਿਆਂ ਦਾ ਹੌਂਸਲਾ ਕਰਨ ਬੱਚੇ ਕਿਤੇ ਜਾਣ ਏ ਨਾ ਅਤੇ ਇਹਨਾਂ ਨੂੰ ਪ੍ਰੋਪਰ ਦੀ ਪ੍ਰੋਪਰ ਪੂਰੀ ਦੀ ਪੂਰੀ ਗ੍ਰੈਜੂਏਸ਼ਨ ਇੱਥੇ ਹੀ ਮਿਲਣੀ ਚਾਹੀਦੀ ਹੈ ਜੋ ਕਿ ਸਾਡੇ ਦੇਸ਼ ਦੇ ਸੁਧਾਰ ਲਈ ਬਹੁਤ ਜ਼ਰੂਰੀ ਹੈ ਅਤੇ ਇਹਦੇ ਨਾਲ ਹੀ ਸਾਡੇ ਇੱਥੇ ਬਥੇਰੇ ਬੱਚੇ ਫਿਰ ਹੁਣ ਕੋਈ ਇੰਜੀਨੀਅਰ ਬਣਦਾ ਕੋਈ ਮਕੈਨਿਕ ਬਣਦਾ ਹੈ ਕੋਈ ਡੋਕਟਰ ਹੈ ਕੋਈ ਕੁਛ ਉਹ ਇੱਥੇ ਹੀ ਕਰ ਲੈਣ ਉਹਨਾਂ ਨੂੰ ਦੂਜੇ ਦੇਸ਼ਾਂ ਵਿੱਚ ਜਾਣ ਦੀ ਜ਼ਰੂਰਤ ਏ ਨਾ ਪਵੇ ਧੰਨਵਾਦ